ਹੈਲੋ ਫਲਿੱਪਕਾਰਟ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਤੁਹਾਡੇ ਤੋਂ ਨਾ ਇੱਕ ਫਰੋਕ ਮੰਗਵਾਈ ਸੀ ਆਪਣੀ ਬੇਟੀ ਦੇ ਲਈ ਉਹਨੇ ਆਪਣੇ ਜਨਮ ਦਿਨ ਲਈ ਪਾਉਣੀ ਸੀ ਅਤੇ ਉਹ ਉਹਦੇ ਮਾ ਆਪਣੇ ਬਰਡੇ 'ਤੇ ਉਹਨੇ ਪਾਈ ਹੈ ਉਸ ਫਰੋਕ ਦੀ ਸਾਰਿਆਂ ਨੇ ਬਹੁਤ ਤਰੀਫਾਂ ਕੀਤੀਆਂ ਨੇ ਜਿਹਦੇ ਕਰਕੇ ਮੈਂ ਤੁਹਾਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਦੀ ਤੁਸੀਂ ਫੋਟੋ ਮੈਨੂੰ ਭੇਜੀ ਸੀ ਔਨਲਾਈਨ ਉਹ ਸੇਮ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਉਹਦਾ ਕਲਰ ਫੈਬਰਿਕ ਜੋ ਲਿਖਿਆ ਸੀ ਸੇਮ ਸੋਫਟ ਜਿਸ ਤਰ੍ਹਾਂ ਦਾ ਮੈਨੂੰ ਪਸੰਦ ਹੈ ਉਹ ਉਸੇ ਤਰ੍ਹਾਂ ਦਾ ਹੀ ਸੀ ਉਹਦਾ ਪ੍ਰਿੰਟ ਲੈਸ ਵਰਕ ਫਰਿਲ ਜਿਪ ਦਾ ਸਟਾਈਲ ਉਹ ਬਹੁਤ ਵਧੀਆ ਲੱਗੀ ਸਭ ਨੇ ਐਨਾ ਤਾਰੀਫ ਕੀਤੀ ਸਭ ਨੇ ਪੁੱਛਿਆ ਕਿ ਵੀ ਕਿੱਥੋਂ ਲਈ ਹੈ ਮੈਂ ਤੁਹਾਡਾ ਲਿੰਕ ਉਹਨਾਂ ਨੂੰ ਸ਼ੇਅਰ ਕੀਤਾ ਹੈ ਜਿਹਦੇ ਨਾਲ ਤੁਹਾਨੂੰ ਕਾਫੀ ਹੋਰ ਵੀ ਰਿਵਿਊ ਆਉਣਗੇ ਉਹ ਜੋ ਤੁਸੀਂ ਮੈਨੂੰ ਐਗਜ਼ੈਕਟ ਡੇਟ ਦੱਸੀ ਸੀ ਆਪਣੀ ਡਿਲੀਵਰੀ ਵਾਸਤੇ ਕਿ ਇਸ ਤਰੀਕ ਨੂੰ ਸਾਡਾ ਆ ਜਾਵੇਗਾ ਔਡਰ ਉਸ ਤੋਂ ਪਹਿਲਾਂ ਹੀ ਮੈਨੂੰ ਮਿਲ ਗਈ ਜਿਹਦੀ ਮੈਨੂੰ ਉਮੀਦ ਨਹੀਂ ਸੀ ਪਰ ਮੈਂ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਧੰਨਵਾਦ